ਹੈਲੋ ਸਰ ਓਲਾ ਕੰਪਨੀ ਤੋਂ ਬੋਲਦੇ ਪਏ ਸਰ ਅਸੀਂ ਇੱਕ ਕੈਬ ਬੁੱਕ ਕਰਵਾਉਣੀ ਸੀ ਅਸੀਂ ਬਾਬਾ ਬੁੱਢਾ ਸਾਹਿਬ ਜਾਣਾ ਹੈ ਦਰਸ਼ਨ ਵਾਸਤੇ ਅਤੇ ਬਾਬਾ ਬੁੱਢਾ ਸਾਹਿਬ ਤਹਿਸੀਲ ਤਰਨ ਤਾਰਨ ਪਿੰਡ ਝਬਾਲ ਦੇ ਨੇੜੇ ਹੈ ਅਤੇ ਅਸੀਂ ਪਿੰਡ ਜਗਤਪੁਰੇ ਤੋਂ ਜਾਣਾ ਹੈ ਅਤੇ ਅਸੀਂ ਚਾਰ ਤਰੀਕ ਨੂੰ ਜਾਣਾ ਹੈ ਅੱਜ ਇੱਕ ਤਰੀਕ ਹੈ ਅਤੇ ਇੱਕ ਕੈਬ ਬੁੱਕ ਕਰ ਦਿਓ ਤਾਂ ਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰ ਸਕੀਏ ਅਤੇ ਸਾਨੂੰ ਉੱਥੇ ਕੁਝ ਸਮਾਂ ਲੱਗ ਸਕਦਾ ਹੈ ਕਿਉਂਕਿ ਉੱਥੇ ਬਹੁਤ ਸਾਰੀ ਭੀੜ ਹੈ ਬਹੁਤ ਸਾਰੀ ਸੰਗਤ ਹੈ ਦਰਸ਼ਨ ਵਾਸਤੇ ਇਸ ਲਈ ਸਾਨੂੰ ਦੋ ਘੰਟੇ ਲੱਗ ਜਾਣਗੇ ਅਗਰ ਤੁਸੀਂ ਕਿਤੇ ਜਾਣਾ ਹੋਵੇ ਤਾਂ ਦੋ ਘੰਟੇ ਵਾਸਤੇ ਜਾ ਸਕਦੇ ਹੋ ਅਤੇ ਤੁਸੀਂ ਫਿਰ ਹ ਸਾਨੂੰ ਆਣ ਕੇ ਉੱਥੋਂ ਲੈ ਕੇ ਘਰ ਛੱਡ ਦੇਣਾ ਤਾਂ ਕਿ ਅਸੀਂ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰਕੇ ਘਰ ਵਾਪਸ ਆ ਸਕੀਏ ਅਤੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਇਸ ਤੁਸੀਂ ਸਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਇਸ ਲਈ ਇੱਕ ਕੈਬ ਬੁੱਕ ਕਰ ਦਿਓ